ਹੋਲਾ ਮੁਹੱਲਾ ਮਨਾਉਣ ਲਈ ਮੈਂ ਮੋਟਰਸਾਇਕਲ 'ਤੇ ਅਨੰਦਪੁਰ ਸਾਹਿਬ ਜਾ ਰਹੀ ਸੀ ਸਭ ਤੋਂ ਪਹਿਲਾਂ ਮੈਂ ਆਪਣੀ ਬਾਈਕ ਦੀ ਸਰਵਿਸ ਕਰਵਾਈ ਤਾਂ ਜੋ ਲੰਬਾ ਰਸਤਾ ਹੈ ਤਾਂ ਜੋ ਅਰ ਅੜਚਣ ਨਾ ਆਉਣ ਆਵੇ ਫਿਰ ਮੈਂ ਛੋਟਾ ਪੈਕ ਤਿਆਰ ਕੀਤਾ ਜਿਸ ਵਿੱਚ ਮੈਂ ਆਪਣੇ ਕੱਪੜੇ ਸਾਬਣ ਅਤੇ ਬੁਰਸ਼ ਅਤੇ ਦਵਾਈਆਂ ਆਪਣਾ ਖਾਣਾ ਵੀ ਲਿਆ ਤਾਂ ਜੋ ਮੈਨੂੰ ਰਸਤੇ ਵਿੱਚ ਭੁੱਖ ਲੱਗੇ ਤਾਂ ਮੈਂ ਮੈਂ ਮੈਂ ਮੈਂ ਵੱਡੀ ਪਾਣੀ ਦੀ ਬੋਤਲ ਵੀ ਰੱਖ ਲਈ ਅਤੇ ਮੈਂ ਆਪਣੇ ਕੋਲ ਪੰਜ ਹਜ਼ਾਰ ਰੁਪਏ ਵੀ ਲੈ ਲਏ ਤਾਂ ਜੋ ਮੈਂ ਰਸਤੇ ਵਿੱਚ ਲੋੜ ਪੈਣ 'ਤੇ ਵਰਤ ਸਕਾਂ ਮੈਂ ਆਪਣੇ ਮੋਟਰਸਾਇਕਲ 'ਤੇ ਬੈਠਣ ਤੋਂ ਪਹਿਲਾਂ ਆਪਣੇ ਬੂਟ ਵੀ ਪਾ ਲਏ ਅਤੇ ਸਿਰ 'ਤੇ ਹੈਲਮੇਟ ਵੀ ਪਾ ਲਿਆ ਇੱਕ ਮੈਂ ਆਪਣਾ ਫੋਨ ਅਤੇ ਚਾਰਜ ਅਤੇ ਅਤੇ ਹੈਡਫੋਨ ਵੀ ਰੱਖ ਲਏ ਅਤੇ ਮੈਂ ਆਪਣੇ ਮੋਟਰਸਾਇਕਲ 'ਤੇ ਟੰਕੀ ਫੁੱਲ ਕਰਵਾ ਲਈ ਤਾਂ ਜੋ ਮੈਂ ਆਪਣੀ ਯਾਤਰਾ ਸਫਲ ਕਰ ਸਕਾਂ